ਮੈਂ ਮਿਊਜ਼ਿਕ ਦਾ ਸਟੂਡੈਂਟ ਹਾਂ ਬਚਪਨ ਤੋਂ ਲੈ ਕੇ ਮੇਰੀ ਸਕੂਲਿੰਗ ਤੋਂ ਲੈ ਕੇ ਕਾਲਜ ਤੱਕ ਅਤੇ ਯੂਨੀਵਰਸਿਟੀ ਲੈਵਲ ਤੱਕ ਮੈਂ ਬਾਕੀ ਵਿਸ਼ਿਆਂ ਦੇ ਨਾਲ ਨਾਲ ਮਿਊਜ਼ਿਕ ਵੀ ਪੜ੍ਹਿਆ ਬਟ ਜ਼ਿਆਦਾ ਰੁਚੀ ਮੇਰੀ ਬਾਕੀ ਵਿਸ਼ਿਆਂ ਨਾਲੋਂ ਮਿਊਜ਼ਿਕ 'ਚ ਜ਼ਿਆਦਾ ਸੀਗੀ ਔਰ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਮਿਊਜ਼ਿਕ ਆਪਣੇ ਐਜੂਕੇਸ਼ਨਲ ਇੰਸਟੀਚਿਊਟ ਦੇ ਨਾਲ ਨਾਲ ਪ੍ਰਾਈਵੇਟ ਵੀ ਮੈਂ ਸਿੱਖਿਆ ਪੜ੍ਹਿਆ ਸੋ ਇਸ ਕਰਕੇ ਮਿਊਜ਼ਿਕ 'ਚ ਰੁਚੀ ਹੋਣ ਕਰਕੇ ਮੈਂ ਆਪਣੀ ਨੌਕਰੀ ਮਿਊਜ਼ਿਕ 'ਚ ਹੀ ਲੱਭ ਰਿਹਾ ਚਾਹੇ ਉਹ ਸਾਊਡ ਇੰਜਨੀਅਰਿੰਗ ਦੀ ਕੋਈ ਪੋਸਟ ਹੋਏ ਚਾਹੇ ਕੋਈ ਮਿਊਜ਼ਿਕ ਪ੍ਰੋਡਕਸ਼ਨ ਦੀ ਪੋਸਟ ਹੋਏ ਜਾਂ ਕੋਈ ਮਿਊਜ਼ਿਕ ਟੀਚਰ ਦੀ ਕੋਈ ਪੋਸਟ ਹੋਏ ਇਹਦਾ ਰੀਜ਼ਨ ਇਹ ਹੈ ਕਿ ਬੰਦਾ ਆਪਣੀ ਨੌਕਰੀ ਉਸ ਸਬਜੈਕਟ 'ਚ ਪੂਰੇ ਪ੍ਰੋਪਰ ਦਿਲ ਨਾਲ ਕਰ ਸਕਦਾ ਹੈ ਜਿਹਦੇ 'ਚ ਉਹ ਪ੍ਰੋਪਰ ਉਹ ਰੁਚੀ ਰੱਖਦਾ ਹੋਵੇ ਸੋ ਬਚਪਨ ਤੋਂ ਹੀ ਮੈਂ ਮਿਊਜ਼ਿਕ ਪੜ੍ਹਿਆ ਮਿਊਜ਼ਿਕ ਸਿੱਖਿਆ ਮਿਊਜ਼ਿਕ ਦੀ ਪ੍ਰੈਕਟਿਸ ਕਰ ਰਿਹਾਂ ਔਰ ਅਗਰ ਮੈਂ ਕੱਲ੍ਹ ਨੂੰ ਟੀਚਰ ਵੀ ਬਣਦਾ ਤਾਂ ਸਟੂਡੈਂਟਸ ਨੂੰ ਜ਼ਿਆਦਾ ਜ਼ਿਆਦਾ ਮਿਹਨਤ ਕਰਵਾ ਸਕਦਾ ਕਿਉਂਕਿ ਮੇਰੀ ਖੁਦ ਦੀ ਰੁਚੀ ਹੈ ਮੇਰਾ ਫੇਵਰੇਟ ਸਬਜੈਕਟ ਹੈ ਪੜ੍ਹਿਆ ਔਰ ਮੈਂ ਯੂਨੀਵਰਸਿਟੀ ਲੈਵਲ 'ਤੇ ਟੋਪ ਵੀ ਕੀਤਾ ਇਹ ਸਬਜੈਕਟ 'ਚ ਤਾਂ ਕਰਕੇ ਮੈਂ ਆਪਣੀ ਨੌਕਰੀ ਮਿਊਜ਼ਿਕ ਦੇ ਰਿਲੇਟਡ ਹੀ ਲੱਭੂਗਾ ਕੋਈ ਵੀ ਹੋਊਗੀ ਜੇ